ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਵੀ ਭਾਰਤ ਵਰਗਾ ਤਾਂ ਦੇਸ਼ ਹੀ ਨਹੀਂ ਇੱਥੇ ਹਰ ਇੱਕ ਚੀਜ਼ ਜਿਹੜੀ ਹੈ ਉਹ ਸ਼ੁੱਧ ਔਰ ਵਧੀਆ ਮਿਲਦੀ ਹੈ ਅਸੀਂ ਆਰਟੀਫਿਸ਼ਅਲ ਚੀਜ਼ਾਂ ਵੱਲ ਕਿਉਂ ਜਾਈਏ ਜਦੋਂ ਸਾਡੇ ਕੋਲ ਓਰਿਜਨਲ ਹੈ ਅਸਲੀ ਹੈ ਸਭ ਕੁਛ ਮੌਜੂਦ ਹੈ ਸਾਨੂੰ ਤਾਂ ਪੈਕਿੰਗ ਵਾਲ਼ੇ ਜਾਂ ਪੀਸੀਆਂ ਹੋਈਆਂ ਚੀਜ਼ਾਂ ਵੀ ਲੈਣ ਦੀ ਲੋੜ ਨਹੀਂ ਸਾਡੇ ਕੋਲ ਤਾਂ ਸਾਰੀ ਚੀਜ਼ ਦਰੱਖਤਾਂ ਤੋਂ ਜਾਂ ਜਿੱਥੋਂ ਵੀ ਜਿਹੜੇ ਪ੍ਰੋਡਕਟ ਆਉਂਦੇ ਨੇ ਉਹ ਮੌਜੂਦ ਨੇ ਔਰ ਮੈਨੂੰ ਇਹ ਬਹੁਤ ਇਹ ਗੱਲ ਪਸੰਦ ਹੈ ਵੀ ਅਸੀਂ ਸਾਰੇ ਜਿਹੜੀ ਸਮੱਗਰੀ ਹੈ ਉਹ ਸੁੱਕੀ ਲਿਆਈਏ ਮਸਾਲੇ ਨੇ ਉਹ ਸੁੱਕੇ ਲਿਆਈਏ ਜਾਂ ਆਪਾਂ ਕਿਸੇ ਤਰ੍ਹਾਂ ਦੇ ਵੀ ਕੋਈ ਬੀਜ ਲੈਦੇ ਹਾਂ ਅਤੇ ਉਹ ਆਪਾਂ ਸਾਬਤ ਰੂਪ ਦੇ ਵਿੱਚ ਲਿਆਈਏ ਅਤੇ ਲਿਆ ਕੇ ਆਪ ਪੀਸ ਕੇ ਆਪਣੀ ਪਸੰਦ ਦਾ ਆਪਣੀ ਲੋੜ ਅਨੁਸਾਰ ਬਣਾਈਏ ਤਾਂ ਉਹ ਮੈਨੂੰ ਲੱਗਦਾ ਵੀ ਉਹਦੇ ਵਿੱਚ ਸਵਾਦ ਵੀ ਵੱਖਰਾ ਹੁੰਦਾ ਔਰ ਤੁਹਾਨੂੰ ਉਹਦੀ ਅਸਲੀਅਤ ਵੀ ਪਤਾ ਹੁੰਦੀ ਹੈ ਵੀ ਇਹ ਕੀ ਨੇ